ਛੇ ਐਪ੍ਰਲ ਦੋ ਹਜ਼ਾਰ ਤਿੰਨ ਅਠਾਰਾਂ ਨਵੰਬਰ ਉੱਨੀ ਸੌ ਚੁਰਾਨਵੇਂ ਅੱਠ ਦਸੰਬਰ ਦੋ ਹਜ਼ਾਰ ਪੰਜ ਅਤੇ ਬਾਰਾਂ ਅਕਤੂਬਰ ਉੱਨੀ ਸੌ ਪਚਾਨਵੇਂ ਬਾਈ ਫੈਬਰੇਰੀ ਦੋ ਹਜ਼ਾਰ ਚਾਰ